ਹੈਲੇ ਸਤਿ ਸ੍ਰੀ ਅਕਾਲ ਜੀ ਸ਼ਗਨ ਢਾਬੇ ਤੋੋਂ ਬੋਲਦੇ ਜੀ ਹਾਂਜੀ ਮੈਂ ਦੋ ਘੰਟੇ ਪਹਿਲਾਂ ਇੱਕ ਆਰਡਰ ਬੁੱਕ ਕੀਤਾ ਤਾ ਜੀ ਮਟਰ ਪਨੀਰ ਸ਼ਾਹੀ ਪਨੀਰ ਸਰ੍ਹੋਂ ਦਾ ਸਾਗ ਪਾਲਕ ਪਨੀਰ ਅਤੇ ਮਿਕਸ ਵੈਜ ਦਾ ਜੀ ਅਤੇ ਮੇਰਾ ਆਰਡਰ ਹੁਣ ਤੱਕ ਮੇਰੇ ਕੋਲ ਨਹੀਂ ਆਇਆ ਪਹੁੰਚਿਆ ਅਤੇ ਤੁਹਾਡੀ ਐਪ ਵਿੱਚ ਮੈਂ ਚੈੱਕ ਕੀਤਾ ਉਸ ਵਿੱਚ ਦੱਸਿਆ ਗਿਆ ਹੈ ਕਿ ਪੰਜ ਮਿੰਟ ਤੱਕ ਤੁਹਾਡਾ ਆਰਡਰ ਤੁਹਾਡੇ ਕੋਲ ਪਹੁੰਚ ਜੁਗਾ ਪਰ ਪਿਛਲੇ ਇੱਕ ਘੰਟੇ ਤੋਂ ਹੁਣ ਤੱਕ ਮੇਰੇ ਕੋਲ ਨਹੀਂ ਆ ਪਹੁੰਚਿਆ ਕਿਆ ਮੈਂ ਜਾਣ ਸਕਦਾ ਹਾਂ ਕਿ ਕਿਉਂ ਇਹ ਮੇਰੇ ਆਰਡਰ ਵਿੱਚ ਆਉਣ ਵਿੱਚ ਕਿਉਂ ਦੇਰੀ ਹੋ ਰਹੀ ਹੈ ਅਗਰ ਤੁਸੀਂ ਟਾਈਮ 'ਤੇ ਨਹੀਂ ਪਹੁੰਚਾ ਸਕਦੇ ਤਾਂ ਤੁਸੀਂ ਮੈਨੂੰ ਆਪਣੇ ਮਾਲਕ ਦ ਢਾਬੇ ਦੇ ਮਾਲਕ ਦਾ ਨੰਬਰ ਦਿਉ ਮੈਂ ਉਸ ਨਾਲ ਗੱਲ ਕਰਾਂ ਮੈਂ ਆਪਣੀ ਪੈਮ ਆਰਡਰ ਦਾ ਪੇਮੈਂਟ ਵੀ ਆਨਲਾਈਨ ਕਰ ਚੁੱਕਿਆ ਹਾਂਜੀ ਤੁਸੀਂ ਮੈਨੂੰ ਆਪਣੇ ਮਾਲਕ ਦਾ ਨੰਬਰ ਦੱਸੋ ਤਾਂ ਮੈਂ ਉਹਦੇ ਨਾਲ ਗੱਲ ਕਰ ਸਕਾਂ ਵੀ ਹਾਂ ਵੀ ਏਦਾਂ ਏਦਾਂ ਆਰਡਰ ਕੀਤਾ ਸੀ ਹੁਣ ਤੱਕ ਮੇਰੇ ਕੋਲ ਆਰਡਰ ਵਾਪਸ ਨਹੀਂ ਮੇਰੇ ਕੋਲ ਪਹੁੰਚਿਆ ਨਹੀਂ ਹੈਗਾ ਮੇਰਾ ਆਰਡਰ